ਹਾਂ ਪ੍ਰੀਤੀ ਤੂੰ ਬੋਲ ਰਹੀ ਆ ਵਧੀਆ ਤੂੰ ਦੱਸ ਵਧੀ ਚੱਲਦੀ ਪਈ ਆ ਹੋਰ ਤੂੰ ਸੁਣਾ ਤੇਰਾ ਖੇਤੀ ਦਾ ਕੰਮ ਕਿਵੇਂ ਵਧੀਆ ਚੱਲਦਾ ਪਿਆ ਅੱਛਾ ਇੱਥੇ ਤਾਂ ਉਹ ਆਏ ਸੀਗੇ ਗ੍ਰੀਨ ਰੈਵੋਲਿਉਸ਼ਨ ਬਾਰੇ ਦੱਸਦੇ ਪਏ ਸੀਗੇ ਤੁਹਾਡੇ ਵੀ ਆਏ ਸੀ ਤੈਨੂੰ ਪਤਾ ਨਹੀਂ ਲੱਗਾ ਉਹ ਤਾਂ ਆਪਣੀ ਭਲਾਈ ਲਈ ਸਾਰਾ ਭਾਸ਼ਣ ਜਿਹਾ ਦੇ ਕੇ ਗਏ ਵੀ ਤੁਸੀਂ ਉਹ ਫਸਲ ਬਦਲ ਬਦਲ ਕੇ ਲਾਇਆ ਕਰੋ ਤੁਹਾਡੀ ਹਰਿਆਲੀ ਜਿਹੜੀ ਮੁੱਕੀ ਜਾਂਦੀ ਆ ਉਹਨੂੰ ਕਿਵੇਂ ਆਪਾਂ ਵਾਪਸ ਲਿਆਣਾ ਹੈਗਾ ਜਿਵੇਂ ਆਪਾਂ ਫਸਲ ਉਹ ਕਹਿੰਦੇ ਸੀ ਵੀ ਝੋਨਾ ਘੱਟ ਲਾਇਆ ਕਰੋ ਤੁਸੀਂ ਐਂ ਕਹਿੰਦੇ ਸੀ ਹਮ ਹਮ ਤੂੰ ਸੁਣਿਆ ਨਹੀਂ ਅੱਛਾ ਉਹ ਇਹ ਕਹਿੰਦੇ ਸੀ ਵੀ ਤੁਸੀਂ ਝੋਨਾ ਘੱਟ ਲਾਓ ਕਿਉਂਕਿ ਝੋਨੇ ਲਈ ਆਪਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ ਨਾ ਤਾਂ ਪਾਣੀ ਜਿਹੜਾ ਮੁੱਕਦਾ ਜਾਂਦਾ ਪਿਆ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਆ ਉਹਦਾ ਪੱਧਰ ਨੀਚੇ ਹੁੰਦਾ ਜਾਂਦਾ ਪਿਆ ਤਾਂ ਕਰਕੇ ਉਹ ਕਹਿੰਦੇ ਸੀ ਵੀ ਝੋਨਾ ਤੁਸੀਂ ਘੱਟ ਲਾਇਆ ਕਰੋ ਅਤੇ ਲਾਉਣਾ ਤਾਂ ਮਤਲਬ ਕਿ ਤੁਸੀਂ ਪਾਣੀ ਦਾ ਅਲੱਗ ਸਿਸਟਮ ਬਣਾਓ ਵੀ ਜਿਹਦੇ ਨਾਲ ਤੁਹਾਡਾ ਪਾਣੀ ਜ਼ਿਆਦਾ ਖਰਚ ਨਾ ਹੋਵੇ ਅਤੇ ਫਸਲਾਂ ਤੁਸੀਂ ਬਦਲ ਬਦਲ ਕੇ ਲਾਇਆ ਕਰੋ ਵੀ ਹਰ ਸਾਲ ਇੱਕੋ ਫਸਲ ਨਾ ਲਾਇਆ ਕਰੋ ਜਿਵੇਂ ਇਸ ਸਾਲ ਆਪਾਂ ਕਣਕ ਅਲੱਗ ਅਲੱਗ ਫਸਲਾਂ ਲਾਇਆ ਕਰੋ ਇਹਦੇ ਨਾਲ ਜਿਹੜੀ ਆਪਣੀ ਮਿੱਟੀ ਆ ਉਹ ਉਪਜਾਊ ਬਣ ਜਾਊਗੀ ਮਤਲਬ ਉਪਜਾਊ ਰਹੂਗੀ ਆਪਣੇ ਲਈ ਫਾਇਦਾ ਹੀ ਹੈ ਇੱਕ ਹਿਸਾਬ ਦਾ ਉਹ ਤਾਂ ਹੈ ਯਾਰ ਆਪਾਂ ਨੂੰ ਝੋਨੇ ਤੋਂ ਫਾਇਦਾ ਤਾਂ ਹੈ ਪਰ ਇਹ ਵੀ ਤਾਂ ਦੇਖ ਯਾਰ ਨੁਕਸਾਨ ਵੀ ਤਾਂ ਕਿੰਨਾ ਜੇ ਆਪਣੀ ਮਿੱਟੀ ਉਪਜਾਊ ਨਾ ਰਹੀ ਜੇ ਪਾਣੀ ਖਤਮ ਹੋ ਗਿਆ ਫਿਰ ਆਪਾਂ ਨੂੰ ਕਿੰਨਾ ਨੁਕਸਾਨ ਹੋਵੇਗਾ ਪਾਣੀ ਤੋਂ ਬਿਨਾਂ ਤਾਂ ਆਪਣਾ ਗੁਜ਼ਾਰਾ ਹੀ ਹੈ ਨਹੀਂ ਗਾ ਜੇ ਪਾਣੀ ਨਾ ਹੋਇਆ ਆਪਣੀ ਅਗਲੀ ਪੀੜ੍ਹੀਆਂ ਕਿਵੇਂ ਰਹੂਗੀ ਆਪਾਂ ਕਿਵੇਂ ਰਹਾਂਗੇ ਉਹੀ ਸੋਚ ਨਾ ਅਤੇ ਨਾਲੇ ਝੋਨਾ ਤਾਂ ਫਿਰ ਉਹ ਪਾਣੀ ਵੀ ਵਾਹ ਵਾਹ ਚਾਹੀਦਾ ਉਹਨੂੰ ਤਾਂ ਝੋਨੇ ਵਾਸਤੇ ਹਮ ਇਹ ਤਾਂ ਹੋਰ ਅੱਗੇ ਹੌਲੀ ਹੌਲੀ ਹੋਰ ਘੱਟ ਜਾਣਾ ਤਾਂ ਕਰਕੇ ਆਪਾਂ ਨੂੰ ਹੁਣ ਇਹਦਾ ਧਿਆਨ ਰੱਖਣਾ ਪੈਣਾ ਵੀ ਆਪਾਂ ਝੋਨੇ ਦੀ ਫਸਲ ਜਿਹੜੀ ਘੱਟ ਲਗਾਈਏ ਅਤੇ ਇੱਕ ਆਪਾਂ ਫਸਲ ਬਦਲ ਬਦਲ ਕੇ ਲਗਾਈ ਜਾਈਏ ਹਮ ਹਮ ਜੇ ਹਰਾ ਭਰਿਆ ਹੋਏਗਾ ਫਿਰ ਆਪਾਂ ਨੂੰ ਸ਼ੁੱਧ ਵਾਤਾਵਰਣ ਮਿਲੇਗਾ ਸ਼ੁੱਧ ਹਵਾ ਮਿਲੇਗੀ ਜਿਹੜੀ ਸਾਹ ਦੀ ਪ੍ਰੋਬਲਮ ਅੱਜ ਕੱਲ੍ਹ ਇੰਨੀ ਆਈ ਜਾਂਦੀ ਸਮੱਸਿਆ ਕਿੰਨੀ ਤਾਂ ਉਹਨਾਂ ਤੋਂ ਆਪਾਂ ਬਚੇ ਰਹਾਂਗੇ ਆਪਣਾ ਹੀ ਭਲਾ ਇਹਦੇ 'ਚ ਹਮ ਤਾਂ ਆਪਾਂ ਸਿਰਫ ਆਪਣਾ ਫਾਇਦਾ ਨਹੀਂ ਨਾ ਵੇਖਣਾ ਆਪਣੇ ਆਉਣ ਵਾਲੀ ਪੀੜ੍ਹੀਆਂ ਦਾ ਵੀ ਅਤੇ ਬਾਕੀ ਲੋਕਾਂ ਦਾ ਵੀ ਫਾਇਦਾ ਵੇਖੀਏ ਉਹਨਾਂ ਦੇ ਨੁਕਸਾਨ ਬਾਰੇ ਸੋਚੀਏ ਉਹ ਹੀ ਸਾਰਾ ਕੁਝ ਸਮਝਾ ਕੇ ਗਏ ਸੀ ਉਹ ਤਾਂ ਆਪਣਾ ਪੰਜਾਬ ਜਿਹੜਾ ਹਰਾ ਭਰਾ ਬਣਾਈਏ ਆਪਾਂ ਆਪਣਾ ਯੋਗਦਾਨ ਦਈਏ ਇਹਨਾਂ ਕੰਮਾਂ 'ਚ ਹਮ ਤੂੰ ਵੀ ਯੋਗਦਾਨ ਪਾਈਂ ਮੈਂ ਵੀ ਯੋਗਦਾਨ ਪਾਉਂਗੀ ਹਮ ਚੱਲ ਠੀਕ ਆ ਸਤਿ ਸ਼੍ਰੀ